ਮੈਂ ਸਤਨਾਮ ਸਿੰਘ ਪਿੰਡ ਬਾਦਲ ਤੋਂ ਬੋਲ ਰਿਹਾ ਹਾਂ ਮੈਂ ਐਮਾਜੋਨ ਤੋਂ ਐਮ ਆਈ ਦੇ ਹੈਡਫੋਨ ਮੰਗਵਾਏ ਸੀ ਇਹ ਹੈਡਫੋਨ ਮੈਨੂੰ ਕੱਲ੍ਹ ਹੀ ਮਿਲੇ ਅਤੇ ਕੱਲ੍ਹ ਸ਼ਾਮ ਨੂੰ ਮੈਂ ਇਹਨਾਂ ਨੂੰ ਵਰਤਿਆ ਵਰਤੋਂ ਦੇ ਸਮੇਂ ਮੈਨੂੰ ਇੱਕ ਸਪੀਕਰ ਵਿੱਚੋਂ ਆਵਾਜ਼ ਨਹੀਂ ਸੁਣਾਈ ਦਿੱਤੀ ਮੈਂ ਹੈਡਫੋਨ ਨੂੰ ਚਾਰਜ ਵੀ ਕਰਿਆ ਅਤੇ ਉਸ ਤੋਂ ਬਾਅਦ ਵਰਤੋਂ ਕਰੀ ਫਿਰ ਵੀ ਮੈਨੂੰ ਉਸ ਸਪੀਕਰ ਵਿੱਚੋਂ ਆਵਾਜ਼ ਨਹੀਂ ਸੁਣੀ ਮੈਂ ਇਸ ਹੈਡਫੋਨ ਨੂੰ ਵਾਪਸ ਕਰਨਾ ਚਾਹੁੰਦਾ ਹਾਂ ਅਤੇ ਇਹ ਵੀ ਸਲਾਹ ਦਿੰਦਾ ਦਿਆਂਗਾ ਕਿ ਕੋਈ ਵੀ ਚੀਜ਼ ਮੰਗਵਾਉਣ ਤੋਂ ਪਹਿਲਾਂ ਉਸਦੇ ਰਿਵਿਊ ਪੜ੍ਹ ਲੈਣਾ ਲੈਣੇ ਚਾਹੀਦੇ ਹਨ ਤਾਂ ਕਿ ਅਸੀਂ ਵਾਧੂ ਦੀ ਖੱਜਲ ਖੁਆਰੀ ਦਾ ਸ਼ਿਕਾਰ ਨਾ ਹੋਈਏ ਨਾ ਸਾਨੂੰ ਆਪਣਾ ਕੀਮਤੀ ਸਮਾਂ ਖਰਾਬ ਕਰਨਾ ਪਵੇ ਨਾ ਹੀ ਸਾਨੂੰ ਹੋਰ ਮੁਸ਼ਕਿਲਾਂ ਜਿਵੇਂ ਪੈਸਿਆਂ ਦਾ ਨੁਕਸ਼ਾਨ ਅਤੇ ਆਦਿ ਦੀ ਝਲਣਾ ਪਵੇ ਕੋਈ ਵੀ ਪ੍ਰੋਡਕਟ ਜਾਂ ਕੋਈ ਵੀ ਸਮਾਨ ਮੰਗਵਾਉਂਦੇ ਸਮੇਂ ਉਸ ਦੇ ਰਿਵਿਊ ਉਸ ਦੀ ਗੁਣਵੱਤਾ ਲਈ ਜੋ ਵੀ ਪਹਿਲਾਂ ਤੋਂ ਵਰਤੋਂ ਕੀਤੇ ਗਏ ਕਸਟਮਰਾਂ ਦਾ ਐਕਸਪੀਰੀਅੰਸ ਸਾਨੂੰ ਵੇਖਣ ਨੂੰ ਮਿਲੇ ਅਸੀਂ ਉਹਨਾਂ ਨੂੰ ਵੇਖਾਂਗੇ ਉਸ ਤੋਂ ਬਾਅਦ ਉਸ ਪ੍ਰੋਡਕਟ ਨੂੰ ਮੰਗਵਾਉਣ ਦੇ ਚਾਹਵਾਨ ਹੋਵਾਂਗੇ ਧੰਨਵਾਦ